ਮੈਂ ਕੁਝ ਸਮਾਂ ਪਹਿਲਾਂ ਹੀ ਸਨਸਕਰੀਮ ਲਈ ਸੀ ਜਿਹੜੀ ਕਿ ਮੇਰੇ ਫੇਸ ਨੂੰ ਬਹੁਤ ਵਧੀਆ ਸੂਟ ਕੀਤੀ ਜਿਸ ਨਾਲ ਮੇਰੀ ਸਕਿਨ ਪੂਰੀ ਹੀ ਕਲੀਅਰ ਹੋ ਗਈ ਅਤੇ ਇਸ ਮੇਰੇ ਸ ਫੇਸ 'ਤੇ ਡੱਲਨੈੱਸ ਵੀ ਘੱਟ ਗਈ ਸੀ ਇਸ ਦਾ ਇਫੈਕਟ ਬਹੁਤ ਵਧੀਆ ਰਿਹਾ ਮੇਰੇ ਲਈ ਅਤੇ ਐਕਸਪੀਰੀਐਂਸ ਵੀ ਬਹੁਤ ਵਧੀਆ ਸੀ ਜਿਹੜੀ ਕਿ ਮੈਂ ਆਪਣੇ ਨਾਲ ਦੀ ਸ਼ੌਪ ਤੋਂ ਹੀ ਖਰੀਦੀ ਸੀ ਅਤੇ ਡਿਸਕਾਊਂਟ ਚੱਲ ਰਿਹਾ ਸੀ ਅਤੇ ਮੈਨੂੰ ਵਧੀਆ ਪਰਾਈਜ਼ ਨਾਲ ਇਹ ਮਿਲ ਗਈ ਸੀ